ਕੁੜੀਆਂ ਅਤੇ ਔਰਤਾਂ ਦੁਆਰਾ ਖੇਡੀਆਂ ਜਾਣ ਵਾਲੀਆਂ ਮੁੱਖ ਖੇਡਾਂ ਹੁੰਦੀਆਂ ਹਨ ਗੁੱਡੀਆਂ ਪਟੋਲੇ ਗੈਸ ਸਿਲੰਡਰ ਦੇ ਸੈੱਟ ਉਹਨਾਂ ਨੂੰ ਲੈ ਕੇ ਦਿੱਤੇ ਜਾਂਦੇ ਹਨ ਸ਼ੁਰੂ ਤੋਂ ਹੀ ਉਹਨਾਂ ਨੂੰ ਕਿਹਾ ਜਾਂਦਾ ਵੀ ਹਾਂ ਤੁਸੀਂ ਰਸੋਈ ਦਾ ਕੰਮ ਕਰੋ ਅਤੇ ਕੁੜੀਆਂ ਨੂੰ ਚਾਅ ਵੀ ਹੁੰਦਾ ਰਸੋਈ ਦੇ ਸੈੱਟ ਲੈ ਕੇ ਘਰ ਘਰ ਖੇਡਣਾ ਅਤੇ ਵਾਰ ਵਾਰ ਗੁੱਡੀਆਂ ਨਾਲ ਖੇਡਣਾ ਗੁੱਡੀ ਦਾ ਵਿਆਹ ਕਰਨਾ ਜਿਹੜੇ ਮੁੰਡੇ ਹੁੰਦੇ ਨੇ ਉਹਨਾਂ ਨੂੰ ਸ਼ੁਰੂ ਤੋਂ ਸਿਖਾਇਆ ਜਾਂਦਾ ਵੀ ਤੁਸੀਂ ਫੁੱਟਬੋਲ ਖੇਡਣੀ ਹੈ ਹੋਕੀ ਖੇਡਣੀ ਹੈ ਕ੍ਰਿਕਟ ਮੈਚ ਦੇਖਣਾ ਕ੍ਰਿਕਟ ਮੈਚ ਖੇਡਣਾ ਅਤੇ ਸ਼ੁਰੂ ਤੋਂ ਹੀ ਜਿਹੜਾ ਇਹ ਫਰਕ ਹੈ ਇਹਨੂੰ ਬਣਾਇਆ ਗਿਆ ਪਹਿਲਾਂ ਤੋਂ ਹੀ ਵੀ ਬੱਚੇ ਦੇ ਦਿਮਾਗ 'ਚ ਜਿਵੇਂ ਕਹਿੰਦੇ ਨੇ ਬੱਚਾ ਕੱਚਾ ਲੋਹਾ ਹੁੰਦਾ ਉਹਦੇ ਦਿਮਾਗ 'ਚ ਜੋ ਵੀ ਤੁਸੀਂ ਭਰੋਂਗੇ ਉਹ ਚੀਜ਼ਾਂ ਉਹਨਾਂ ਦੇ ਮਾਇੰਡ 'ਚ ਭਰੀ ਜਾਂਦੀ ਹੈ ਹੁਣ ਤੁਸੀਂ ਇਸ ਤਰੀਕੇ ਨਾਲ ਲੜਕਾ ਅਤੇ ਲੜਕੀ ਦੇ ਵਿੱਚ ਇਹ ਫਰਕ ਬਣਾਏ ਗਏ ਨੇ ਸ਼ੁਰੂ ਤੋਂ ਉਹਨਾਂ ਨੂੰ ਸਿਖਾਇਆ ਜਾਂਦਾ ਵੀ ਤੁਸੀਂ ਰਸੋਈ ਦੇ ਕੰਮ ਕਰਨੇ ਨੇ ਕੁੜੀਆਂ ਵਾਲੇ ਕੰਮ ਕਰਨੇ ਨੇ ਅਤੇ ਮੁੰਡਿਆਂ ਨੂੰ ਕਿਹਾ ਜਾਂਦਾ ਤੁਸੀਂ ਮੁੰਡਿਆਂ ਵਾਲੇ ਕੰਮ ਕਰਨੇ ਨੇ ਬਾਹਰ ਦੇ ਕੰਮ ਕਰਨੇ ਨੇ ਵੈਸੇ ਹੁਣ ਇਹ ਮਾਨਸਿਕਤਾ ਕਾਫੀ ਹੱਦ ਤੱਕ ਬਦਲ ਚੁੱਕੀ ਹੈ ਪਰ ਅਜੇ ਵੀ ਮੋਸਟਲੀ ਰਸੋਈ ਦੇ ਕੰਮ ਲਈ ਸ ਇਹ ਸਮਝਿਆ ਜਾਂਦਾ ਵੀ ਕੁੜੀਆਂ ਹੀ ਜ਼ਿੰਮੇਵਾਰ ਨੇ ਪ੍ਰਮੁੱਖ ਤੌਰ 'ਤੇ ਕੁੜੀਆਂ ਨੂੰ ਖੇਡਣ ਲਈ ਉਦਾਹਰਨ ਦੇ ਤੌਰ 'ਤੇ ਦਿੱਤੀਆਂ ਜਾਂਦੀਆਂ ਨੇ ਗੁੱਡੀਆਂ ਪਟੋਲੇ ਖੇਡਦੇ ਨੇ ਘਰ ਘਰ ਬਣਾ ਕੇ ਖੇਡਦੇ ਨੇ ਵਾ ਗੁੱਡੀਆਂ ਦੇ ਵਿਆਹ ਕਰਦੇ ਨੇ ਅਤੇ ਉਸ ਤੋਂ ਇਲਾਵਾ ਉਹਨਾਂ ਨੂੰ ਰਸੋਈ ਦੇ ਸੈੱਟ ਲਿਆ ਕੇ ਦਿੱਤੇ ਜਾਂਦੇ ਨੇ ਉਹ ਖਾਣਾ ਬਣਾ ਕੇ ਦਿਖ ਦਿਖਾਉਂਦੀਆਂ ਨੇ ਉਹਨਾਂ ਤੋਂ ਇਲਾਵਾ ਹੋਰ ਕੁਛ ਘਰ ਸਜਾ ਲਿਆ ਘਰ ਦੀ ਸਜਾਵਟ ਘਰ ਬਣਾਉਣਾ ਘਰ ਸਾਫ ਕਰਨਾ ਅਜਿਹੀਆਂ ਖੇਡਾਂ ਖੇਡਦੀਆਂ ਹਨ ਵੀ ਇਸ ਤੋਂ ਇਲਾਵਾ ਹੁਣ ਪੀਚੋ ਵਗੈਰਾ ਖੇਡਦੀਆਂ ਹਨ ਜਿਹਦੇ ਨਾਲ ਉਹਨਾਂ ਨੂੰ ਲੱਗਦਾ ਹੈ ਕਿ ਜੋ ਵੀ ਖੇਡਾਂ ਕੁੜੀਆਂ ਦੇ ਮਾਮਲੇ 'ਚ ਖੇ ਕੁੜੀਆਂ ਦੇ ਉਹਦੇ 'ਚ ਖੇਡੀਆਂ ਜਾਂਦੀਆਂ ਨੇ ਉਹ ਖੇਡਾਂ ਮੁ ਮੁੰਡੇ ਨਹੀਂ ਖੇਡਦੇ ਇਹ ਡਿਫਰੈਂਸ ਜਿਹੜਾ ਸ਼ੁਰੂ ਤੋਂ ਰੱਖਿਆ ਜਾਂਦਾ